ਜੀ ਹਾਂ ਮੈਂ ਇੱਕ ਵਾਰ ਆਪਣੇ ਹੱਥੋਂ ਬਣਾ ਕੇ ਕਾਰਡ ਆਪਣੇ ਛੋਟੇ ਭਾਈ ਨੂੰ ਉਸਦੇ ਜਨਮਦਿਨ 'ਤੇ ਉਹਨੂੰ ਤੋਹਫੇ ਦੇ ਤੌਰ 'ਤੇ ਦਿੱਤਾ ਸੀ ਅਤੇ ਉਹ ਉਸ ਕਾਰਡ ਨੂੰ ਲੈ ਕੇ ਜਦੋਂ ਉਸਨੂੰ ਪੜ੍ਹਿਆ ਉਹਨੂੰ ਲੈ ਕੇ ਬਹੁਤ ਖੁਸ਼ ਹੋਇਆ ਸੀ